ਭਾਰਤ ਵਿੱਚ ਸਾਈਕਲ ਨਾਲ ਘੁੰਮਣ ਲਈ ਕਈ ਸੁਝਾਅ ਹਨ ਕੁਝ ਪ੍ਰਮੁੱਖ ਸਥਾਨ ਹੇਠ ਲਿਖੇ ਹਨ ਕੇਰਲ ਮਨਾਰ ਅਤੇ ਅਲਪੁਜਾ ਵਿੱਚ ਚਾਹ ਦੇ ਬਾਗਬਾਨਾ ਵਿਚਕਾਰ ਸਾਈਕਲ ਚਲਾਉਣ ਦਾ ਇੱਕ ਸੁੰਦਰ ਅਨੁਭਵ ਹੈ ਹਿਮਾਚਲ ਪ੍ਰਦੇਸ਼ ਮਨਾਲੀ ਤੋਂ ਲੇਹ ਤੱਕ ਦੀ ਸਾਈਕਲ ਯਾਤਰਾ ਪ੍ਰਸਿੱਧ ਹੈ ਜੋ ਚੁਣੌਤੀਪੂਰਨ ਪਰ ਦਿਲਚਸਪ ਹੈ ਲਦਾਖ ਲੱਦਾਖ ਦੀ ਵਾਦੀ ਵਿੱਚ ਸਾਈਕਲਿੰਗ ਦਾ ਇੱਕ ਅਨੋਖਾ ਤਜ਼ਰਬਾ ਹੈ ਖਾਸਕਰ ਖਰਦੁੰਗਲਾ ਪਾਸ ਜੋ ਦੁਨੀਆ ਦਾ ਸਭ ਤੋਂ ਉੱਚਾ ਮੋਟਰ ਹੈ ਗੋਆ ਗੋਆ ਦੇ ਸਮੁੰਦਰੀ ਤੱਟਾਂ ਅਤੇ ਪਿੰਡਾਂ ਵਿੱਚ ਸਾਈਕਲਿੰਗ ਕਰਨਾ ਬਹੁਤ ਹੀ ਮਜ਼ੇਦਾਰ ਅਤੇ ਆਰਾਮਦਾਇਕ ਹੈ ਰਾਜਸਥਾਨ ਉਦੈਪੁਰ ਅਤੇ ਜੈਸਲਮੇਰ ਦੇ ਇਤਿਹਾਸਿਕ ਸਥਾਨਾਂ ਨੂੰ ਸਾਈਕਲਿੰਗ ਰਾਹੀਂ ਵੇਖਣਾ ਇੱਕ ਯਾਦਗਾਰ ਅਨੁਭਵ ਹੋ ਸਕਦਾ ਹੈ ਇਹ ਸਥਾਨ ਸਾਈਕਲਿੰਗ ਲਈ ਸੁੰਦਰ ਦ੍ਰਿਸ਼ ਅਤੇ ਚੁਣੌਤੀਆਂ ਦੋਵਾਂ ਦੀ ਪੇਸ਼ਕਸ਼ ਕਰਦੇ ਹਨ